ਯੋਗਾ ਇੱਕ ਕਲਾ ਹੈ ਜੋ ਮਨੁੱਖੀ ਸਰੀਰ ਅਤੇ ਮਨ ਵਿਚਕਾਰ ਆਪਸੀ ਸਾਂਝ ਪੈਦਾ ਕਰਦੀ ਹੈ ਜੇਕਰ ਯੋਗ ਰਾਹੀਂ ਸਰੀਰ ਮਨ ਅਤੇ ਰੂਹ ਦਰਮਿਆਨ ਸੰਤੁਲਨ ਕਾਇਮ ਕੀਤਾ ਜਾ ਸਕਦਾ ਹੈ ਯੋਗਾ ਦੇ ਵੱਖ ਵੱਖ ਤਰ੍ਹਾਂ ਦੇ ਪ੍ਰਕਾਰ ਹਨ ਇਸ ਦੇ ਨਾਲ ਹੁੰ ਵਿਅਕਤੀ ਆਪਣੀ ਮਾਨਸਿਕ ਅਤੇ ਸਰੀਰਿਕ ਸੰਤੁਲਿਤ ਨੂੰ ਬਣਾ ਕੇ ਰੱਖ ਸਕਦੇ ਹਨ ਯੋਗਾ ਮਾਨਸਿਕ ਅਤੇ ਸੰ ਸਰੀਰਿਕ ਸ਼ਾਂਤੀ ਹਾਸਿਲ ਕਰਨ ਦਾ ਸਭ ਤੋਂ ਵਧੀਆ ਅਤੇ ਆਸਾਨ ਤਰੀਕਾ ਮੰਨਿਆ ਜਾਂਦਾ ਹੈ ਜੇਕਰ ਕਿਸੇ ਵਿਅਕਤੀ ਨੂੰ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਕਿ ਸਾਂਹ ਲੈਣ ਦੇ ਵਿੱਚ ਬਿਮਾਰੀ ਮੋਟਾਪਾ ਹਸ ਹੋਣ ਦੇ ਨਾਲ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਮਾਧਾਨ ਯੋਗਾ ਦੇ ਨਾਲ ਠੀਕ ਹੋ ਜਾਂਦਾ ਹੈ ਇਸ ਲਈ ਯੋਗਾ ਨੂੰ ਸਰੀਰਿਕ ਅਤੇ ਸਰੀਰਿਕ ਵਿਵਸਥਾ ਦੇ ਲਈ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਯੋਗਾ ਕਰਨ ਦੇ ਕਈ ਸਾਰੇ ਫ਼ਾਇਦੇ ਹੁੰਦੇ ਹਨ ਜਿਵੇਂ ਕਿ ਸਰੀਰ ਦੀ ਤਾਕਤ ਆ ਵਿਕਾਸ ਹੁੰਦਾ ਇਸ ਦੇ ਨਾਲ ਦੂਸਰਾ ਜੀ ਇਸਦੇ ਆਪਣੇ ਮਾਨਸਿਕ ਯਾਨੀ ਕਿ ਮਨ ਦਾ ਵਿਕਾਸ ਹੁੰਦਾ ਗਾ ਤੀਸਰੇ ਨੰਬਰ 'ਤੇ ਜੀ ਆਪਣੀ ਜਿਹੜੀ ਆਲਸ ਆ ਗਈ ਉਹ ਦੂਰ ਹੋ ਜਾਂਦੀ ਹੈਗੀ ਅਤੇ ਇਸ ਦੇ ਨਾਲ ਨਾਲ ਵਿਅਕਤੀ ਦੀ ਰਚਨਾਤਮਕ ਜਿਹੜੀ ਸ਼ਕਤੀ ਹੁੰਦੀ ਆ ਉਹ ਵੀ ਵੱਧ ਜਾਂਦੀ ਆ ਗੀ ਵਿਅਕਤੀ ਹਮੇਸ਼ਾਂ ਇੱਕ ਵਧੀਆ ਮਤਲਬ ਕਿ